ਪੰਜਾਬ ਵਿੱਚ ਲੋਕ ਆਪਣੀ ਰਚਨਾਤਮਿਕ ਅਤੇ ਕਲਾਤਮਿਕ ਪ੍ਰਤਿਭਾ ਨੂੰ ਇਸ ਤਰ੍ਹਾਂ ਪ੍ਰਗਟ ਕਰਦੇ ਹਨ ਜਿਵੇਂ ਕਿ ਜਿਵੇਂ ਕਿ ਗੀਤ ਸੰਗੀਤ ਕਵਿਤਾ ਅਤੇ ਕਲਾਤਮਿਕ ਰੂਪ ਦੇ ਵਿੱਚ ਜੋ ਸਾਡੇ ਅੰਦਰ ਹੁਨਰ ਹੁੰਦਾ ਹੈ ਉਸ ਨੂੰ ਬਾਹਰ ਲਿਆਉਣਾ ਜਿਵੇਂ ਕਿ ਆਰਟ ਐਂਡ ਕਰਾਫਟ ਹੋ ਗਈ ਅਤੇ ਗਾਣ ਗਾਉਣਾ